ਕੁਛ ਸਾਲ ਪਹਿਲਾਂ ਤਾਂ ਸਮਾਰਟਫੋਨ ਹੁੰਦੇ ਹੀ ਨਹੀਂ ਸਨ ਉਦੋਂ ਤਾਂ ਨੋਕੀਆਂ ਦੇ ਬਟਨਾਂ ਵਾਲੇ ਫੋਨ ਹੀ ਸਭ ਕੋਲ ਹੁੰਦੇ ਸਨ ਉਹਨਾਂ ਉੱਤੇ ਸਿਰਫ਼ ਫੋਨ ਕੀਤਾ ਜਾ ਸਕਦਾ ਸੀ ਅਤੇ ਫੋਨ ਸੁਣਿਆ ਜਾ ਸਕਦਾ ਸੀਗਾ ਥੋੜ੍ਹੀਆਂ ਬਹੁਤ ਛੋਟੀਆਂ ਮੋਟੀਆਂ ਗੇਮਾਂ ਖੇਡੀਆਂ ਜਾ ਸਕਦੀਆਂ ਸਨ ਪਰ ਹੁਣ ਦੇ ਸਮਾਰਟ ਫੋਨਾਂ ਵਿੱਚ ਬਹੁਤ ਫੀਚਰ ਹਨ ਇਹਨਾਂ ਉੱਤੇ ਅਸੀਂ ਕਿਸੇ ਨੂੰ ਵੀ ਵੀਡੀਓ ਕੋਲ ਵੀ ਕਰ ਸਕਦੇ ਹਾਂ ਗੇਮਾਂ ਵੀ ਕੇ ਕਿੰਨੀਆਂ ਨਵੀਆਂ ਨਵੀਆਂ ਵਧੀਆ ਵਧੀਆ ਖੇਡ ਸਕਦੇ ਹਾਂ ਫੋਟੋਆਂ ਵੀ ਖਿੱਚ ਸਕਦੇ ਹਾਂ ਅਸੀਂ ਵੀਡੀਓ ਵੀ ਬਣਾ ਸਕਦੇ ਹਾਂ ਅਤੇ ਹੋਰ ਬਹੁਤ ਕੁਛ ਕਰ ਸਕਦੇ ਹਾਂ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਦਾ ਨੈਟਵਰਕ ਵੀ ਬਹੁਤ ਚੰਗਾ ਹੈ ਪਹਿਲਾਂ ਤਾਂ ਨੈਟਵਰਕ ਕਿਤੇ ਹੀ ਸ਼ਹਿਰਾਂ ਵਿੱਚ ਹੀ ਮਿਲਦਾ ਸੀਗਾ ਹੁਣ ਤਾਂ ਨੈਟਵਰਕ ਪਿੰਡਾਂ ਪਿੰਡਾਂ ਵਿੱਚ ਹੀ ਅਤੇ ਪਹਾੜਾਂ ਤੱਕ ਵੀ ਪਹੁੰਚਿਆ ਹੋਇਆ ਹੈ ਅਤੇ ਫਾਈਵ ਜੀ ਇੰਟਰਨੈਟ ਚੱਲ ਪਿਆ ਹੈ ਜੋ ਕਿ ਬਹੁਤ ਤੇਜ਼ ਹੈ ਕੋਈ ਵੀ ਵੱਡੀ ਤੋਂ ਵੱਡੀ ਵੀ ਅ ਅਸੀਂ ਜੇਕਰ ਕੋਈ ਮੂਵੀ ਡਾਊਨਲੋਡ ਕਰਨੀ ਹੋਵੇ ਤਾਂ ਕਾਫੀ ਜਲਦੀ ਹੋ ਜਾਂਦੀ ਹੈ ਮੈਂ ਖੁਦ ਏਅਰਟੈਲ ਦਾ ਸਿੰਮ ਵਰਤਦਾ ਹਾਂ ਜਿਸ ਦੇ ਵਿੱਚ ਉਹ ਫਾਈਵ ਜੀ ਨੈਟਵਰਕ ਵੀ ਦਿੰਦੇ ਹਨ ਮੈਨੂੰ ਮਹੀਨੇ ਦਾ ਤਕਰੀਬਨ ਕੋਈ ਤਿੰਨ ਸੌ ਰੁਪਏ ਜਾਂ ਉਸ ਤੋਂ ਵੀ ਘੱਟ ਹੀ ਡਾਟਾ ਪੈਕ ਅਤੇ ਰੀਚਾਰਜ ਉੱਤੇ ਖਰਚਣਾ ਪੈਂਦਾ ਹੈ